ਹਾਂਜੀ ਅਸੀਂ ਆਪਣੇ ਮੋਬਾਈਲ 'ਤੇ ਨਿਊਜ਼ ਫੀਡ ਪੜ੍ਹਦੇ ਹਾਂ ਰੁਟੀਨ ਵਿੱਚ ਪੜ੍ਹਦੇ ਹਾਂ ਇਹਦੇ ਵਿੱਚ ਪੰਜਾਬ ਕੇਸਰੀ ਜਗਬਾਣੀ ਦੈਨਿਕ ਭਾਸਕਰ ਦੈਨਿਕ ਜਾਗਰਣ ਅਖਬਾਰਾਂ ਅਸੀਂ ਪੜ੍ਹਦੇ ਹਨ ਅਤੇ ਦੂਸਰਾ ਜਿਹੜੇ ਚੈਨਲ ਹੈ ਪੀ ਟੀ ਸੀ ਹਰਮਨ ਪੰਜਾਬੀ ਜਿੰਨੇ ਵੀ ਚੈਨਲ ਹੈ ਬਾਹਰਲੇ ਫੋਰਨ ਦੇ ਸਾਰੇ ਅਸੀਂ ਇਹਦੇ ਗਾਹਕ ਤਾਂ ਨਹੀਂ ਹੈਗੇ ਪਰ ਅਸੀਂ ਫਰੀ ਵਾਲੇ ਜਿਹੜੇ ਚੈਨਲ ਹੈ ਉਹ ਦੇਖਦੇ ਹਾਂ ਅਤੇ ਅਸੀਂ ਇਹ ਚੈਨਲ ਜਿਹੜੇ ਆ ਪ੍ਰੋਪਰ ਦੇਖਦੇ ਹਾਂ ਉਹਦੇ ਨਾਲ ਬੰਦਾ ਉਹਦੇ ਨਾਲ ਅਸੀਂ ਅਪਡੇਟ ਰਹਿੰਦੇ ਹਾਂ ਸਾਨੂੰ ਨਵੀਂ ਨਿਊਜ਼ ਜਿਹੜੀ ਹੈ ਸਾਨੂੰ ਮਿਲਦੀ ਅਸੀਂ ਜਾਣਕਾਰੀ ਲੈ ਕੇ ਆਪਣੀ ਖਬਰ ਨੂੰ ਹੋਰ ਮਜ਼ਬੂਤ ਬਣਾਉਣ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਸਾਡੀ ਜਿਹੜੀ ਜਾਣਕਾਰੀ ਹੈ ਚੈਨਲਾਂ ਨਾਲ ਵੀ ਵੱਧਦੀ ਹੈ ਅਤੇ ਜਿਹੜੇ ਨਿਊਜ਼ ਫੀਡ ਨਿਊਜ਼ ਪੇਪਰ ਆ ਉਹ ਜੇ ਕੁਛ ਵੀ ਸਵੇਰੇ ਸਾਜਰੇ ਜਾਂ ਸ਼ਾਮ ਨੂੰ ਵੀ ਪਤਾ ਲੱਗ ਜਾਂਦਾ ਕਿ ਕੱਲ੍ਹ ਨੂੰ ਕਿਹੜੀ ਨਿਊਜ਼ ਛਪਣੀ ਹੈ ਅਤੇ ਅਸੀਂ ਆਪਣੇ ਮੋਬਾਈਲ ਦੇ ਵਿੱਚ ਜਿਹੜੇ ਚੈਨਲ ਹੈ ਜਿਹੜੇ ਨਿਊਜ਼ ਪੇਪਰ ਜਿਹੜੇ ਆ ਈ ਪੇਪਰ ਆ ਜਿੰਨੇ ਵੀ ਆ ਸਾਰੇ ਫੀਲਡ ਕੀਤੇ ਹੋਏ ਹਨ ਉਹ ਅਖਬਾਰ ਸਾਨੂੰ ਫਾਇਦਾ ਦਿੰਦੇ ਹਨ ਅਤੇ ਅਸੀਂ ਉਹਦੇ ਨਾਲ ਹੀ ਆਪਣਾ ਜਿਹੜਾ ਕਾਰੋਬਾਰ ਵੀ ਵਧਾ ਰਹੇ ਹਾਂ ਬ ਸਾਨੂੰ ਪਤਾ ਰਹਿੰਦਾ ਕਿ ਕੀ ਹੋ ਗਿਆ ਕਿਹੜੀ ਆਪਾਂ ਠੱਗੀ ਹੋਈ ਜਾਂ ਕੁਛ ਵੀ ਉਹਦੇ ਨਾਲ ਪਹਿਲਾਂ ਹੀ ਬੰਦਾ ਮੈਚਿਓਰ ਹੋ ਜਾਂਦਾ ਅਪਡੇਟ ਰਹਿੰਦਾ ਹੈ ਸਾਨੂੰ ਇਹ ਨਿਊਜ਼ ਚੈਨਲ ਜਾਂ ਨਿਊਜ਼ ਪੇਪ ਮੋਬਾਇਲ 'ਤੇ ਫੀਡ ਕਰਨੀਆਂ ਵੀ ਚਾਹੀਦੀਆਂ ਹਨ ਕਿ ਉਹ ਮੌਕੇ 'ਤੇ ਜਾ ਕੇ ਤਾਂ ਦੂਜੇ ਚੈਨਲਾਂ ਦੇ ਗਾਹਕ ਹੁਣ ਵੀ ਆ ਜੇ ਫਰੀ ਮਿਲਦੇ ਆ ਤਾਂ ਜ਼ਰੂਰ ਤੁਸੀਂ ਇਹ ਚੈਨਲ ਜਿਹੜੇ ਆ ਅਪਲੋਡ ਕਰਨੇ ਚਾਹੀਦੇ ਹਨ